ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਭਾਰਤ ਇੱਕ ਭਿੰਨਤਾਵਾਂ ਵਾਲਾ ਦੇਸ਼ ਹੈ ਜਿੱਥੇ ਕਿ ਅਲੱਗ ਅਲੱਗ ਧਰਮਾਂ ਦੇ ਲੋਕ ਰਹਿੰਦੇ ਹਨ ਅਤੇ ਉਹਨਾਂ ਦੇ ਧਰਮ ਦੇ ਅਕੋਡਿੰਗ ਹੀ ਉਹਨਾਂ ਦੇ ਆਪਣੇ ਰੀਤੀ ਰਿਵਾਜ ਹਨ ਜਿਵੇਂ ਕਿ ਸਾਡੇ ਪਿੰਡ ਦੇ ਸਥਾਨਿਕ ਰੀਤੀ ਰਿਵਾਜਾਂ ਬਾਰੇ ਸਥਾਨਕ ਖੁਰਾਕਾਂ ਬਾਰੇ ਮੈਂ ਦੱਸਣ ਜਾ ਰਹੀ ਹਾਂ ਜਿਵੇਂ ਕਿ ਸਾਡੇ ਪਿੰਡ ਵਿੱਚ ਬੱਚਿਆਂ ਦੀ ਸੁੱਖ ਸ਼ਾਤੀ ਵਾਸਤੇ ਬੱਚਿਆਂ ਦੀ ਚੰਗੀ ਸਿਹਤ ਦੇ ਲਈ ਚੇਚਕ ਦੀ ਬਿਮਾਰੀ ਤੋਂ ਬਚਾਅ ਦੇ ਲਈ ਮਾਤਾ ਸ਼ੀਤਲਾ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਉਸਦੇ ਸੰਬੰਧ ਵਿੱਚ ਗੁਲਗੁਲੇ ਕਚੌਰੀਆਂ ਬਣਾਈਆਂ ਜਾਂਦੀਆਂ ਹਨ ਅਤੇ ਉਹਨਾਂ ਦਾ ਮੱਥਾ ਟੇਕਿਆ ਜਾਂਦਾ ਹੈ ਤਾਂ ਕਿ ਬੱਚਿਆਂ ਨੂੰ ਜਿਹੜੀ ਚੇਚਕ ਦੀ ਬਿਮਾਰੀ ਹੈ ਜਾਂ ਜਿਸ ਨੂੰ ਆਪਾਂ ਦੇਸੀ ਲੈਂਗਵੇਂਜ ਦੇ ਵਿੱਚ ਛੋਟੀ ਮਾਤਾ ਜਾਂ ਬੜੀ ਮਾਤਾ ਕਹਿ ਦਿੰਦੇ ਹਨ ਉਸਦੇ ਸੰਬੰਧ ਵਿੱਚ ਹੁੰਦੀ ਹੈ ਅਤੇ ਇਸ ਤੋਂ ਇਲਾਵਾ ਸੰਗਰਾਂਦ ਦੇ ਮਹੀਨੇ ਵਿੱਚ ਦੇਸੀ ਘਿਓ ਦਾ ਕੜਾਹ ਪ੍ਰਸ਼ਾਦ ਬਣਾ ਕੇ ਮੱਥਾ ਟੇਕਿਆ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਪਿੰਡ ਦੀ ਸੁੱਖ ਸ਼ਾਤੀ ਵਾਸਤੇ ਪਿੰਡ ਦੇ ਭਲੇ ਵਾਸਤੇ ਪਿੰਡ ਦੇ ਖੇੜੇ ਦੇ ਵਿੱਚ ਮਿੱਠੇ ਚੌਲਾਂ ਦਾ ਮੱਥਾ ਟੇਕਿਆ ਜਾਂਦਾ ਹੈ ਤਾਂ ਤਾਂ ਜੋ ਪਿੰਡ ਦੇ ਵਿੱਚ ਸੁੱਖ ਸ਼ਾਤੀ ਬਣੀ ਰਹੇ ਅਤੇ ਬੱਚਿਆਂ ਦੇ ਵਿੱਚ ਵੀ ਸ ਉਹਨਾਂ ਦੀ ਸਿਹਤ ਸੰਬੰਧੀ ਸਾਰਾ ਕੁਛ ਠੀਕ ਠਾਕ ਰਹੇ